ਮੇਰੀ ਪਹਿਲੀ ਪਰਚੇਸ ਆਈਫੋਨ ਅਲੈਵੰਨ ਪਰੋ ਮੈਕਸ ਸੀਗੀ ਬਹੁਤ ਵਧੀਆ ਫੋਨ ਰਿਹਾ ਮੇਰੇ ਕੋਲ ਕੈਮਰੇ ਤੋਂ ਲੈ ਕੇ ਬੈਟਰੀ ਬੈਕਅਪ ਤੋਂ ਲੈ ਕੇ ਸਕਰੀਨ ਔਸਮ ਸੀਗਾ ਸਾਰਾ ਬੈਟਰੀ ਵੀ ਸਿਰਾ ਗੱਲਬਾਤ ਆ ਯਾਰ ਕੋਈ ਕਮੀ ਨਹੀਂ ਫੋਨ ਦੇ ਵਿੱਚ ਹਰੇਕ ਜਗ੍ਹਾ 'ਤੇ ਜਾਂਦੇ ਹਾਂ ਜਿੱਥੇ ਨਾਲੇ ਇਹਦੀ ਮੇਨ ਤਾਂ ਇਹਦੀ ਸਕਿਓਰਟੀ ਬਹੁਤ ਵਧੀਆ ਹੈ ਆਈਕਲੋਡ ਸਟੋਰੇਜ ਹੈ ਕੋਈ ਹੈਕ ਦਾ ਕੋਈ ਇਸ਼ੂ ਨਹੀਂ ਕੋਈ ਕਰ ਨਹੀਂ ਸਕਦਾ ਹੈਗਾ ਗਿਰ ਵੀ ਜਾਵੇ ਇਨਕੇਸ ਵੈਸੇ ਤਾਂ ਯਾਰ ਫੋਨ ਨੂੰ ਹੁ ਹੁੰਦਾ ਨਹੀਂ ਹੈਗਾ ਜੇ ਇਨਕੇਸ ਕਿਤੇ ਗਿਰ ਵੀ ਜਾਵੇ ਤਾਂ ਇਹਦਾ ਕਦੇ ਡਾਟਾ ਆਪਣਾ ਲੋਸ ਨਹੀਂ ਹੋ ਸਕਦਾ ਹੈਗਾ ਇੱਕ ਨੋਟ 'ਤੇ ਆਪਾਂ ਬੈਕਅਪ ਚੜ੍ਹਾ ਕੇ ਹੀ ਰੱਖਦੇ ਹਾਂ ਇਹਦਾ ਸਾਰਾ ਅਤੇ ਅੱਗੇ ਪਿੱਛੇ ਕੋਈ ਇਹ 'ਚ ਕੋਈ ਫੋਲਟ ਨਹੀਂ ਪੈਂਦਾ ਹੈਗਾ ਚਾਰ ਸਾਲ ਹੋ ਗਏ ਆ ਯੂਜ ਕਰਦੇ ਨੂੰ ਕਦੇ ਕੋਈ ਦਿੱਕਤ ਨਹੀਂ ਆਈ ਫੋਨ ਦੇ ਵਿੱਚ ਐਨ ਉੱਦਾਂ ਦਾ ਉਵੇਂ ਹੀ ਚਲਦਾ ਮਲਾਈ ਵਾਂਗੂੂ ਬਿਲਕੁਲ ਨਜ਼ਾਰਾ ਲਿਆਂਦਾ ਪਿਆ ਫੋਨ ਨੇ ਪੂਰੇ ਬਾਕੀ ਲਿਆਂਦਾ ਸੀ ਐਪਲ ਯੂਨੀਕੋਰਨ ਦੇ ਵਾਲਿਆਂ ਤੋਂ ਇੱਕ ਲੱਖ ਦਸ ਹਜ਼ਾਰ ਦਾ ਫੋਨ ਉਦੋਂ ਮੈਂ ਬਾਏ ਕੀਤਾ ਸੀਗਾ ਲਿਆ ਸੀ ਅਤੇ ਅੱਜ ਵੀ ਉਹ ਫੋਨ ਮੁੱਲ ਮੋੜ ਰਿਹਾ ਪੂਰਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਫੋਨ ਦੇ ਵਿੱਚ ਆਈ ਹੈਗੀ ਹਲਕਾ ਥੋੜ੍ਹਾ ਬਹੁਤਾ ਚਲੋ ਉੱਨੀ ਇੱਕੀ ਆਉਂਦੀ ਓ ਰਹਿੰਦੀ ਪਰ ਮੇਰੇ ਵਾਲੇ 'ਚ ਵਿੱਚ ਐਦਾਂ ਦੀ ਕੋਈ ਦਿੱਕਤ ਨਹੀਂ ਆਈ ਹੈਗੀ